ਹਰ ਬਾਈਕ ਨੂੰ ਫਸਟ ਏਡ ਦੀਆਂ ਇਹ ਗੱਲਾਂ ਪਤਾ ਹੋਣੀਆਂ ਬਹੁਤ ਜ਼ਰੂਰੀ ਹਨ ਜਿਵੇਂ ਕਿ ਜਦੋਂ ਸੜਕ 'ਤੇ ਜਾਂਦਿਆਂ ਕੋਈ ਹਾਸਤਾ ਵਾਪਰ ਜਾਂਦਾ ਹੈ ਤਾਂ ਉਸ ਸਮੇਂ ਘਬਰਾਉਣਾ ਨਹੀਂ ਚਾਹੀਦਾ ਉਹਦੀ ਜਗ੍ਹਾ 'ਤੇ ਡਿੱਗੇ ਹੋਏ ਵਿਅਕਤੀ ਨੂੰ ਪਤਾ ਕਰਨਾ ਲਗਾਉਣਾ ਚਾਹੀਦਾ ਹੈ ਕਿ ਇਸ ਦੇ ਕਿਸ ਅੰਗ 'ਤੇ ਸੱਟ ਲੱਗੀ ਹੈ ਜੇਕਰ ਸਰੀਰ ਦੇ ਅੰਗ ਦੀ ਟੁੱਟ ਭੱਜ ਹੋਈ ਹੈ ਤਾਂ ਪਤਾ ਲਗਾਏ ਅਤੇ ਉਸ ਨੂੰ ਕੋਈ ਵੀ ਕੱਪੜਾ ਲੈ ਕੇ ਚੰਗੀ ਤਰ੍ਹਾਂ ਬੰਨ੍ਹ ਦੇਣਾ ਚਾਹੀਦਾ ਹੈ ਤਾਂ ਕਿ ਉਹ ਜ਼ਿਆਦਾ ਹਿਲੇ ਨਾ ਕੁਛ ਰਾਹਤ ਉਸ ਨੂੰ ਮਿਲ ਜਾਵੇ ਹਰ ਇੱਕ ਵਿਅਕਤੀ ਕੋਲ ਫਸਟ ਏਡ ਗਰਮ ਪੱਟੀ ਵੈਂਡੜ ਸਪਲਾਡੀਨ ਕਰੀਮ ਪੈਨ ਕਿਲਰ ਗੋਲੀ ਆਦਿ ਹੋਣੀ ਬਹੁਤ ਜ਼ਰੂਰੀ ਹੈ